ਸਾਡਾ ਸੋਚਣਾ ਇਹ ਹੈ ਕਿ ਚਿੱਤਰਕਾਰੀ ਲੋਕਾਂ ਦੇ ਲਈ ਬਹੁਤ ਉਪਚਾਰਕ ਅਤੇ ਲਾਭਦਾਇਕ ਹੋ ਸਕਦੀ ਆ ਕਿਉਂਕਿ ਜਿਹੜਾ ਵੀ ਇਨਸਾਨ ਕਿਸੇ ਦੀ ਚਿੱਤਰਕਾਰੀ ਨੂੰ ਦੇਖਦਾ ਹੈ ਉਸਦੇ ਮਨ ਦੇ ਵਿੱਚ ਇੱਕ ਬਹੁਤ ਹੀ ਚੰਗਾ ਅਤੇ ਪ੍ਰਭਾਵਸ਼ਾਲੀ ਵਿਚਾਰ ਉੱਠਦਾ ਹੈ ਕਿ ਇਹ ਚੀਜ਼ ਇੱਦਾਂ ਹੋਈ ਕਿਵੇਂ ਇਹ ਚੀਜ਼ਾਂ ਇੱਦਾਂ ਬਣੀਆਂ ਕਿਵੇਂ ਉਹ ਬਹੁਤ ਹੀ ਚਿੱਤਰਕਾਰ ਜਿਹੜੇ ਹੁੰਦੇ ਨੇ ਉਹ ਦਿਲ ਤੋਂ ਆਪਣੀ ਉਹਨਾਂ ਦੇ ਵਿੱਚ ਝਲਕਦੀ ਹੁੰਦੀ ਆ ਤਸਵੀਰ ਜੋ ਬਣਾਉਂਦੇ ਨੇ ਹਰੇਕ ਫੋਟੋ ਦੇ ਵਿੱਚ ਜਿਹੜੇ ਵੀ ਚਿੱਤਰਕਾਰ ਨੇ ਉਹ ਬਣਾਈ ਹੁੰਦੀ ਹੈ ਉਹ ਕਿਸੇ ਨਾ ਕਿਸੇ ਰੀਜਨ ਦੇ ਕਰਕੇ ਬਣਾਈ ਹੁੰਦੀ ਹੈ ਉਸ ਦਾ ਕਿਸੇ ਨਾ ਕਿਸੇ ਪਿੱਛੇ ਜ਼ਰੂਰ ਕੋਈ ਪੱਖ ਹੁੰਦਾ ਹੈ ਵੀ ਉਸ ਨੇ ਉਹ ਚੀਜ਼ ਕਿਉਂ ਬਣਾਈ ਹੈ ਅਤੇ ਉਹ ਚੀਜ਼ ਦੇਖਣ ਵਾਲੇ ਦੀ ਨਿਗ੍ਹਾ ਹੁੰਦੀ ਹੈ ਜੋ ਕਿ ਉਸ ਤਸਵੀਰ ਦੇ ਵਿੱਚ ਉਸ ਦੀ ਝਲਕ ਨੂੰ ਮਹਿਸੂਸ ਕਰਦਾ ਹੈ ਜਿਸ ਚਿੱਤਰਕਾਰ ਨੇ ਉਹ ਚੀਜ਼ ਬਣਾਈ ਹੋਵੇ ਉਸ ਦਾ ਦੁੱਖ ਝਲਕਦਾ ਹੈ ਜੇ ਕਿਸੇ ਨੇ ਦੁਖੀ ਚਿੱਤਰਕਾਰੀ ਕੀਤੀ ਹੈ ਤਾਂ ਉਹਦੇ ਵਿੱਚ ਉਹਦਾ ਦੁੱਖ ਝਲਕਦਾ ਹੈ ਇਸੇ ਤਰ੍ਹਾਂ ਅੱਜ ਤੱਕ ਬਹੁਤ ਕੁਛ ਚੀਜ਼ਾਂ ਇਹੋ ਜਿਹੀਆਂ ਹਨ ਜਿਹੜੀਆਂ ਸਾਨੂੰ ਚਿੱਤਰ ਚਿੱਤਰਕਾਰ ਦੇ ਥਰੂ ਹੀ ਮਿਲੀਆਂ ਹਨ